ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਦੋ ਐੱਮ ਐੱਲ ਏ ਆ ਵਿਧਾਇਕ ਜਿਹੜੇ ਚੁਣ ਕੇ ਗਏ ਆ ਉਹਨਾਂ ਦੇ ਵਿੱਚ ਸ਼੍ਰੀ ਨਛੱਤਰ ਪਾਲ ਅਤੇ ਦੂਸਰੇ ਡਾਕਟਰ ਸੁਖਵਿੰਦਰ ਸੁੱਖੀ ਜੀ ਇਹ ਬੜਾ ਵਧੀਆ ਕੰਮ ਕਰ ਰਹੇ ਆ ਜਿਹੜੇ ਡਾਕਟਰ ਸੁੱਖੀ ਜੀ ਆ ਉਹ ਅਕਾਲੀ ਦਲ ਨੂੰ ਬਿਲੌਂਗ ਕਰਦੇ ਆ ਅਤੇ ਜਿਹੜੇ ਨਛੱਤਰ ਪਾਲ ਜੀ ਉਹ ਅਕਾਲੀ ਦਲ ਬੀ ਐੱਸ ਪੀ ਨੂੰ ਬਿਲੌਂਗ ਕਰਦੇ ਆ ਦੋਨੋਂ ਵਧੀਆ ਕੰਮ ਕਰ ਰਹੇ ਆ ਔਰ ਜ਼ਿਲ੍ਹੇ ਲਈ ਅੱਛਾ ਕੰਮ ਕਰਨ ਦੀ ਅਸੀਂ ਆਸ ਰੱਖਦੇ ਹਾਂ